ਵੈਸੇ ਤਾਂ ਪੰਜਾਬ ਦੇ ਵਿੱਚ ਹਰ ਧਾਰਮਿਕ ਸੰਸਥਾਵਾਂ ਜਿਹੜੀਆਂ ਹਨ ਉਹ ਆਪਣੇ ਧਰਮ ਦਾ ਸਮਰਥਨ ਕਰਦੀਆਂ ਹਨ ਪਰ ਜੇ ਮੈਂ ਗੱਲ ਕਰਾਂ ਤਾਂਬਹੁਤ ਜ਼ਿਆਦਾ ਐਸੇ ਲੋਕ ਹਨ ਕ੍ਰਿਸ਼ਚਨ ਲੋਕ ਨੇ ਜਿਨ੍ਹਾਂ ਨੂੰ ਆਪਾਂ ਚਰਚ ਵਗੈਰਾ 'ਚ ਦੇਖਦੇ ਹਾਂ ਕਿ ਉਹ ਸਿਰਫ਼ ਔਰ ਸਿਰਫ਼ ਆਪਣੇ ਧਰਮ ਦੇ ਬਾਰੇ ਹੀ ਜ਼ਿਆਦਾ ਚਰਚਾ ਕਰਦੇ ਹਨ ਕਈ ਧਰਮਾਂ 'ਚ ਤਾਂ ਇਸ ਤਰ੍ਹਾਂ ਹੈ ਕਿ ਦੂਸਰੇ ਧਰਮਾਂ ਨੂੰ ਵੀ ਚੰਗਾ ਕਿਹਾ ਜਾਂਦਾ ਪਰ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਚਰਚ ਜਾਂ ਕਿਸੇ ਇੱਕ ਮਠ ਨੂੰ ਲਿਆ ਜਾਵੇ ਤਾਂ ਉਹ ਸਿਰਫ਼ ਇੱਕੋ ਹੀ ਚੀਜ਼ 'ਤੇ ਜ਼ਿਆਦਾ ਜ਼ੋਰ ਦਿੰਦਾ ਹੈ ਤੋ ਚਰਚ ਵਗੈਰਾ 'ਚ ਜਾ ਦਿਖਾਇਆ ਜਾਂਦਾ ਹੈ ਕਿ ਹਾਂ ਕਿਸੇ ਨੂੰ ਠੀਕ ਕਰ ਦਿੱਤਾ ਹੈ ਉਹ ਸ਼ਕਤੀਆਂ ਹਨ ਕਿ ਉਹਨਾਂ ਨੂੰ ਠੀਕ ਕਰ ਦਿੰਦੀਆਂ ਹਨ ਉਸੇ ਵੇਲੇ ਹੀ ਸੋ ਇਹ ਚੀਜ਼ਾਂ ਜਿਹੜੀਆਂ ਹਨ ਇਹ ਲੱਗਦਾ ਹੈ ਕਿ ਧਰਮ ਆਪਣਾ ਜਿਹੜਾ ਹੈ ਉਹ ਜ਼ਿਆਦਾ ਸਮਰਥਨ ਕਰ ਰਿਹਾ ਹੈ